ਸਾਡੇ ਰਾਜ ਅਤੇ ਸਮਾਜ ਅਤੇ ਸੱਭਿਆਚਾਰ ਪ੍ਰੰਪਰਾਗਤ ਪਹਿਰਾਵੇ ਦੇ ਜਾਂ ਕੱਪੜੇ ਦੇ ਵਿੱਚ ਆ ਜਾਂਦਾ ਹੈ ਜਿਵੇਂ ਕਿ ਪੁਰਾਣੇ ਟਾਈਮ ਦੇ ਵਿੱਚ ਜੋ ਸਾਡਾ ਪਹਿਰਾਵਾ ਹੁੰਦਾ ਸੀ ਉਹ ਹੀ ਪਹਿਰਾਵਾ ਹੁਣ ਤੱਕ ਸਾਡਾ ਚੱਲਦਾ ਆ ਰਿਹਾ ਹੈ ਇਸ ਦੇ ਵਿੱਚ ਕੁੜਤਾ ਪਜਾਮਾ ਹੋ ਗਿਆ ਚਾਦਰਾ ਤੁਰਲੇ ਵਾਲਾ ਪਰਨਾ ਦੇ ਨਾਲ ਪੰਜਾਬੀ ਜੁੱਤੀ ਕੈਂਠਾ ਇਸ ਤਰ੍ਹਾਂ ਦੇ ਕੱਪੜੇ ਸਾਡੇ ਪਹਿਰਾਵੇ ਦੇ ਵਿੱਚ ਪਾਏ ਜਾਂਦੇ ਹਨ ਜੇ ਗਹਿਣਿਆਂ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਕੜ੍ਹਾ ਜੋ ਕਿ ਅੱਜ ਵੀ ਵਿਆਹਾਂ ਸ਼ਾਦੀਆਂ ਦੇ ਵਿੱਚ ਸ਼ਗਨ ਦੇ ਤੌਰ 'ਤੇ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਮੁੰਦੀ ਜੋ ਕਿ ਕੈਂਠਾ ਹੋ ਗਿਆ ਜੋ ਕਿ ਵਿਆਹਾਂ ਦੇ ਤੌਰ 'ਤੇ ਸ਼ਗਨ ਦੇ ਤੌਰ 'ਤੇ ਇੱਕ ਦੂਜੇ ਦੇ ਪਾਏ ਜਾਂਦੇ ਹਨ ਅਤੇ ਇਹ ਸਾਡੇ ਖੇਤਰ ਵਿੱਚ ਭਾਈਚਾਰੇ ਵਿੱਚ ਸਾਡੇ ਖੇਤਰ ਦੇ ਭਾਈਚਾਰੇ ਵਿੱਚ ਬਹੁਤ ਹੀ ਵੱਖਰਾ ਹੈ ਕਿਉਂਕਿ ਇਹ ਪਹਿਰਾਵਾ ਜਾਂ ਇਹ ਇਹ ਗਹਿਣੇ ਨੇ ਇਸ ਤਰ੍ਹਾਂ ਦਾ ਜੋ ਕੱਪੜੇ ਨੇ ਉਹ ਹੋਰ ਖੇਤਰਾਂ ਵਿੱਚ ਸਾਨੂੰ ਦੇਖਣ ਨੂੰ ਬਹੁਤ ਘੱਟ ਜਾਂ ਨਹੀਂ ਮਿਲਣਗੇ